ਮੈਂ ਆਈ ਟੀ ਸੈਕਟਰ ਦੇ ਵਿੱਚ ਨੌਕਰੀਆਂ ਲਈ ਬਹੁਤ ਬੜਾ ਫੀਲਡ ਫੀਲ ਹੋ ਗਿਆ ਹੈ ਆਈ ਟੀ ਨੌਕਰੀਆਂ ਵਾਸਤੇ ਆਈ ਟੀ ਦੇ ਇਲਾਵਾ ਆਰਟੀਫਿਸ਼ਲ ਇਟੈਲੀਜੈਂਸ ਵੀ ਜੋ ਅੱਜ ਦਾ ਨਵਾਂ ਸਬਜੈਕਟ ਹੈ ਇਹਦੇ ਵਿੱਚ ਵੀ ਨੌਕਰੀਆਂ ਦੇ ਬਹੁਤ ਜ਼ਿਆਦਾ ਚਾਂਸਿਸ ਹੈ ਅੱਗੇ ਵਧਣ ਵਾਲਾ ਫੀਲਡ ਹੈ ਇਸ ਤੋਂ ਇਲਾਵਾ ਜੋ ਕਮਿਊਨੀਕੇਸ਼ਨ ਫੀਲਡ ਹੈ ਜਿਹਦੇ ਵਿੱਚ ਬਹੁਤ ਸਾਰੇ ਜੋਬਸ ਕ੍ਰੀਏਟ ਹੋਈਆਂ ਆ ਕਮਿਊਨੀਕੇਸ਼ਨ ਫੀਲਡ ਯਾਨੀ ਕਿ ਵੀਡੀਓ ਕਾਲਸ ਆਡੀਓ ਕਾਲਸ ਐਂਡ ਅਪਡੇਟਡ ਇਲੈਕਟਰੋਨਿਕ ਮੀਡੀਆ ਐਂਡ ਇੰਸਟੂਮੈਂਟਸ ਮੈਨੂਫੈਕਚਰਿੰਗ ਆਫ ਮੋਬਾਈਲਸ ਐਂਡ ਮੈਨੂਫੈਕਚਰਿੰਗ ਲੈਪਟੋਪ ਐਂਡ ਐਲ ਅਦਰ ਆਈਟਮਸ ਵਿੱਚ ਰਿਲੇਟਿਡ ਟੂ ਦ ਟੈਕਨੋਲੋਜੀ ਇਹ ਪੂਰੀਆਂ ਹੈਲਪ ਕਰਦੀਆਂ ਮਦਦ ਕਰਦੀਆਂ ਹਨ ਤਾਂ ਇਸ ਤੋਂ ਇਲਾਵਾ ਵੀ ਟੈਕਨੋਲੋਜੀ ਦੇ ਟੈਕਨੋਲਜੀ ਦੇ ਔਰ ਸਾਰੇ ਬਹੁਤ ਸਾਰੇ ਫੀਲਡ ਹੈ ਜਿਵੇਂ ਕਿ ਕੋਈ ਵੀ ਟੈਕਨੀਕਲ ਹੈਂਡ ਹੈ ਜਾਂ ਸੇਫਟੀ ਨਾਲ ਰਿਲੇਟਡ ਫੀਡਲਸ ਹੈ ਉਹਨਾਂ ਦੇ ਉੱਪਰ ਵੀ ਕਿ ਬਹੁਤ ਸਾਰੀਆਂ ਜੋਬ ਨਵੀਆਂ ਕ੍ਰੀਏਟ ਹੋ ਗਈਆਂ ਸੇਫਟੀ ਆਫਿਸਰ ਜਾਂ ਫਿਰ ਇਸ ਤੋਂ ਇਲਾਵਾ ਇਸ ਇਸ ਤੋਂ ਇਲਾਵਾ ਵੀ ਸਾਡੇ ਮੋਨੀਟਰਿੰਗ ਆਫ ਦਾ ਅਲੱਗ ਅਲੱਗ ਤਰ੍ਹਾਂ ਦੀ ਜੋਬ ਨੂੰ ਮੋਨੀਟਰ ਕਰਨਾ ਇਸ ਤਰ੍ਹਾਂ ਇਸਦੇ ਉੱਪਰ ਰਿਸਰਚ ਵਰਕ ਜਿਹੜਾ ਹੈ ਨਵੇਂ ਤਰ੍ਹਾਂ ਦੀਆਂ ਨੌਕਰੀਆਂ ਪੈਦਾ ਕਰ ਸਕਦਾ ਹੈ ਉਹਨਾਂ 'ਤੇ ਵੀ ਮੇਰਾ ਇਨਟਰਸਟ ਰਹਿੰਦਾ ਹੈ